ਮੈਂ ਕਢਾਈ ਅਤੇ ਬੁਣਾਈ ਆਨਲਾਈਨ ਤੋਂ ਬਹੁਤ ਜ਼ਿਆਦਾ ਔਨਲਾਈਨ ਦੇਖ ਦੇਖ ਕੇ ਮੈਂ ਬਹੁਤ ਸਵੈਟਰ ਬਣਾਏ ਪਹਿਲੇ ਛੋਟੇ ਹੁੰਦਿਆਂ ਸਿੰਪਲ ਜਦੋਂ ਬੜੀ ਦੇਰ ਪਹਿਲੇ ਸਿੰਪਲ ਸਵੈਟਰ ਬਣਾ ਲੈਂਦੇ ਸੀ ਬੱਚਿਆਂ ਦੇ ਆਮ ਹੀ ਜਦੋਂ ਜਦੋਂ ਆਨਲਾਈਨ 'ਤੇ ਡਿਜ਼ਾਇਨ ਆਉਣੇ ਸ਼ੁਰੂ ਹੋਏ ਅਤੇ ਮੈਂ ਬਹੁਤ ਵਧੀਆ ਵਧੀਆ ਉਹਦੇ ਤੋਂ ਡਿਜ਼ਾਇਨ ਸਿੱਖ ਸਿੱਖ ਕੇ ਸਵੈਟਰ ਬਣਾਏ ਅਤੇ ਸਾਰਿਆਂ ਨੇ ਬੜੇ ਪਸੰਦ ਕੀਤੇ ਅਤੇ ਹੁਣ ਮੈਂ ਬਹੁਤ ਸਵੈਟਰ ਬਣਾ ਲੈਂਦੀ ਹਾਂ ਅਤੇ ਸਾਰਿਆਂ ਨੂੰ ਵੀ ਮੈਂ ਦੱਸਦੀ ਹਾਂ ਕਿ ਦੇਖੋ ਕਿੰਨੇ ਸੋਹਣੇ ਸੋਹਣੇ ਜਿਹੜੇ ਬਾਜ਼ਾਰ 'ਚ ਡਿਜ਼ਾਇੰਨ ਮਿਲਦੇ ਨੇ ਉਹੀ ਮੈਂ ਸਵੈਟਰ ਬਣਾ ਲੈਂਦੀ ਹਾਂ ਬਹੁਤ ਜ਼ਿਆਦਾ ਅਤੇ ਵਧੀਆ ਵਧੀਆ ਕਦੀ ਆਪਣੇ ਪੋਤਰੇ ਵਾਸਤੇ ਕਦੀ ਆਪਣੇ ਬੱਚਿਆਂ ਵਾਸਤੇ ਕਦੀ ਕੁੜੀਆਂ ਵਾਸਤੇ ਕਦੀ ਮੁੰਡਿਆਂ ਵਾਸਤੇ ਬਹੁਤ ਵਧੀਆ ਵਧੀਆ ਮੈਂ ਸਵੈਟਰ ਬਣਾਏ ਨੇ ਅਤੇ ਉਹਦੇ ਨਾਲ ਮੇਰਾ

ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੁੰਦੀ ਕਿ ਲੋਕੀ ਮੇਰੇ ਸਵੈਟਰ ਬੜੇ ਪਸੰਦ ਕਰਦੇ ਨੇ ਅਤੇ ਜਿਹਦੇ ਨਾਲ ਮੇਰੀ ਮੇਰਾ ਮਤਲਬ ਥੋੜ੍ਹਾ ਹੌਂਸਲਾ ਵੀ ਵੱਧ ਗਿਆ ਕਿ ਮੈਂ ਸੋਹਣੇ ਸੋਹਣੇ ਕਿਤੇ ਬੈਟ ਬੱਲੇ ਕਿਤੇ ਬੋਲ ਕਿਤੇ ਡੋਲ ਬਣੀਆਂ ਹੋਈਆਂ ਕਿਤੇ ਬਹੁਤ ਵਧੀਆ ਵਧੀਆ ਡਿਜ਼ਾਇਨ ਮੈਂ ਸਿਲਾਈਆਂ 'ਚ ਆਨਲਾਈਨ ਦੇਖ ਦੇਖ ਕੇ ਮੈਂ ਪਾਨੀ ਹਾਂ ਅਤੇ ਉਹ ਬਾਜ਼ਾਰ 'ਚ ਕਿੰਨਾ ਰੇਟ ਹੈ ਪਰ ਬਣਾਵਾਂਗੇ ਬਣਾ ਕੇ ਵੀ ਅਤੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ